ਪੰਜਾਬੀ ਲੋਕਾਂ ਦੇ ਨਾਮ ਸੁਨੀਤਾ ਮਹਿੰਦਰ ਜਸ਼ਨ ਸੁਖਦੀਪ ਸੁਖਪਾਲ ਕਿਰਤ ਜੀਵਨ ਜਗਜੀਵਨ ਜੀਵਨਜੋਤ ਰਾਜੂ ਬਬਲਾ ਸਿਮਰਜੀਤ ਸਿਮਰਨ ਜਸਪ੍ਰੀਤ ਸਿਮਰਨਪ੍ਰੀਤ ਕਿਰਨ ਸੁਮਿਤ ਪੁਨੀਤ ਪੱਪਾ ਦੀਸ਼ਾ ਨਿੰਦਰ ਹਰਜਿੰਦਰ ਮਨਦੀਪ ਹਰਨਾਮ ਗੁਰਜੀਤ ਸੁਰਜੀਤ ਬਿੱਟੂ ਟਿੰਕੂ ਜਤਿੰਦਰ ਅਮਰਜੀਤ ਸੁਖਦੇਵ ਸੁਰਿੰਦਰ ਜਸਵਿੰਦਰ ਜਸਮਿੰਦਰ ਰਵਿੰਦਰ ਕੁਲਦੀਪ ਮਨਜੀਤ ਹਰਜੀਤ ਮਨਮੀਤ ਅੰਮ੍ਰਿਤ ਸਰਬਜੀਤ ਸਰਗੁਨ ਹਰਗੁਣ ਗਗਨਦੀਪ ਰੀਨੂ ਬਾਲਾ ਕਿਰਨ ਬਾਲਾ ਮਾਨਸੀ ਪਲਕ ਦਮਨਜੀਤ ਰਾਜੇਸ਼ ਕੁਮਾਰ ਰਕੇਸ਼ ਕੁਮਾਰ ਸ਼ਸ਼ੀ ਕਲਾ ਗੁਰਨਾਮ ਸਿੰਘ ਗੁਰਮੀਤ ਸਿੰਘ